ਸਾਡੇ ਖੇਤਰ ਵਿੱਚ ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਲਈ ਹਾਲੇ ਕਾਫੀ ਕੁਛ ਕਰਨ ਦੀ ਬਹੁਤ ਜ਼ਰੂਰਤ ਹੈ ਆਮ ਤੌਰ 'ਤੇ ਦੇਖਣ ਵਿੱਚ ਆਇਆ ਹੈ ਕਿ ਆਮ ਪਿੰਡਾਂ ਦੇ ਲੋਕਾਂ ਨੂੰ ਆਪਣੀ ਸਿਹਤ ਸ ਸਿਹਤ ਸੇਵਾਵਾਂ ਲੈਣ ਲਈ ਸ਼ਹਿਰਾਂ ਵਿੱਚ ਜਾਂ ਨੇੜੇ ਦੇ ਕਿਸੇ ਕਸਬੇ ਵਿੱਚ ਜਾਣਾ ਪੈਂਦਾ ਹੈ ਸਾਡੀ ਜੋ ਪਿੰਡਾਂ ਦੇ ਵਿੱਚ ਆਮ ਤੌਰ ਜਿਹੜੀ ਸਿਹਤ ਡਿਸਪੈਂਸਰੀਆਂ ਨੇ ਜੋ ਜਿਵੇਂ ਵੀ ਕਲੀ ਜੋ ਕਲੀਨਿਕ ਖੁੱਲੇ ਆ ਉਹ ਕਾਫੀ ਦੂਰ ਨੇ ਅਤੇ ਆਮ ਜਿਹੜੇ ਲੋਕ ਹੈਗੇ ਉਹਨਾਂ ਨੂੰ ਕੋਲ ਪਹੁੰਚਣ ਲਈ ਕਾਫੀ ਸਮਾਂ ਲੱਗਦਾ ਹੈ ਜਿਸ ਨਾਲ ਉਹਨਾਂ ਦੀ ਸਿਹਤ ਵੀ ਹੋ ਜ਼ਿਆਦਾ ਖਰਾਬ ਹੋ ਸਕਦੀ ਹੈ ਜਿਹੜੀਆਂ ਇਸ ਵਿਸ਼ਾਲ ਬਦਲਣ ਦੀ ਜੋ ਬੇਹਤਰੀ ਲਈ ਹੈ ਉਹ ਪੰਜਾਬ ਸਰਕਾਰ ਹੀ ਕਰ ਸਕਦੀ ਹੈ ਵੀ ਜਿਹੜੇ ਕਲੀਨਿਕ ਹੈਗੇ ਆ ਜਾਂ ਫਿਰ ਜਿਹੜੀ ਸਰਕਾਰੀ ਡਿਸਪੈਂਸਰੀਆਂ ਨੇ ਉਹ ਪਿੰਡਾਂ ਦੇ ਵਿੱਚ ਵੱਡੇ ਪੱਧਰ 'ਤੇ ਖੋਲ੍ਹੀਆਂ ਜਾਣ ਤਾਂ ਜੋ ਲੋਕਾਂ ਨੂੰ ਸੁੱਖ ਸੁਵਿਧਾਵਾਂ ਜਿਹੜੀ ਸਿਹਤ ਸੇਵਾਵਾਂ ਹੈਗੀਆਂ ਉਹ ਬਿਲਕੁਲ ਨੇੜੇ ਨੇੜੇ ਮਿਲ ਜਾਣ ਅਤੇ ਇਨ੍ਹਾਂ ਵਿੱਚ ਜਿਹੜਾ ਸਿਸਟਮ ਹੈਗਾ ਇਹਦੇ ਵਿੱਚ ਜਿੰਨੀਆਂ ਵੀ ਡਿਸਪੈਂਸਰੀਆਂ ਨੇ ਜੋ ਵੀ ਕੰਮ ਕਰ ਰਹੀਆਂ ਨੇ ਉਹਨਾਂ ਵਿੱਚ ਕਾਫੀ ਅਸਾਮੀ ਜਿਹੜੀ ਖਾਲੀਆਂ ਨੇ ਉਹ ਭਰੀਆਂ ਜਾਣ ਭਰੀਆਂ ਜਾਣੀਆਂ ਜ਼ਰੂਰੀ ਹਨ